ਭਾਰਤ ਭਾਰਤ ਦੀ ਗੱਲ ਆ ਉਹ ਚਾਹੇ ਪੰਜਾਬ ਦੀ ਜਿਹੜੇ ਹੱਥ ਨਾਲ਼ ਬੁਣੇ ਕੱਪੜੇ ਹੁੰਦੇ ਨੇ ਉਹਨਾਂ ਨੂੰ ਪਾਉਣ ਦਾ ਵੱਖਰਾ ਹੀ ਨਜ਼ਾਰਾ ਹੈ ਇੱਕ ਤਾਂ ਉਹਨਾਂ ਦੀ ਫਿਟਿੰਗ ਵਧੀਆ ਹੁੰਦੀ ਹੈ ਅਤੇ ਦੂਜਾ ਜਿਵੇਂ ਆਪਾਂ ਕਹਿ ਦਿੰਦੇ ਹਨ ਵੱਡੇ ਬਜ਼ੁਰਗਾਂ ਦਾ ਪਿਆਰ ਉਹਨਾਂ ਕੱਪੜਿਆਂ ਵਿੱਚ ਹੁੰਦਾ ਹੈ ਜਾਂ ਫਿਰ ਆਸ਼ੀਰਵਾਦ ਵੀ ਕਹਿ ਸਕਦੇ ਹੋ ਊਂ ਤਾਂ ਵੈਸੇ ਤਾਂ ਰੈਡੀਮੇਡ ਕੱਪੜਿਆਂ ਦੀ ਮਾਰਕੀਟ ਬਹੁਤ ਵੱਡੀ ਹੈ ਪਰ ਜਿੰਨੇ ਵੀ ਇਹ ਰੇਡੀਮੇਡ ਕੱਪੜੇ ਵੱਡੇ ਵੱਡੇ ਬ੍ਰੈਂਡ ਲਾ ਲਉ ਇਹ ਸਾਰੇ ਬਾਹਰ ਦੇ ਬ੍ਰੈਂਡ ਨੇ ਤਾਂ ਇਸ ਤੋਂ ਚੰਗਾ ਆਪਾਂ ਆਪਣੇ ਭਾਰਤ ਆਪਣੇ ਪੰਜਾਬ ਵਿੱਚ ਬੁਣੇ ਹੋਏ ਹੱਥ ਦੇ ਕੱਪੜੇ ਨੂੰ ਪਾਈਏ ਅਤੇ ਉਹਦਾ ਹੀ ਜ਼ਿਆਦਾ ਪ੍ਰਮੋਟ ਕਰੀਏ ਕਿਸੇ ਬਾਹਰ ਦੇ ਬ੍ਰੈਂਡ ਨਾਲ਼ੋਂ ਕਿਉਂਕਿ ਇਹ ਹੱਥ ਦੇ ਕੱਪੜੇ ਸਾਡੇ ਬਹੁਤ ਟਾਈਮ ਤੋਂ ਚੱਲੇ ਆ ਰਹੇ ਹਨ ਅਤੇ ਇਹਨਾਂ 'ਚ ਇਹਨਾਂ ਚ ਆਪਣੇ ਵੱਡੇ ਬਜ਼ੁਰਗਾਂ ਦਾ ਪਿਆਰ ਵੀ ਛੁਪਿਆ ਹੁੰਦਾ ਹੈ ਹੱਥ ਨਾਲ਼ ਬੁਣਿਆ ਕੱਪੜਾ ਨਿੱਘਾ ਅਤੇ ਵਧੀਆ ਹੁੰਦਾ ਹੈ ਅਤੇ ਇਹ ਲੰਬੇ ਸਮੇਂ ਤੱਕ ਟਿਕਦਾ ਹੈ ਹੱਥ ਨਾਲ਼ ਬੁਣੇ ਕੱਪੜੇ ਦੀ ਰੀਤ ਬਹੁਤ ਟਾਈਮ ਤੋਂ ਚੱਲੀ ਆ ਰਹੀ ਹੈ ਪਹਿਲਾਂ ਜਿਵੇਂ ਪਿਛਲੇ ਟਾਈਮ ਵਿੱਚ ਖਾਦੀ ਦਾ ਉਹ ਕ ਖਾਦੀ ਦਾ ਆਵਿਸ਼ਕਾਰ ਕਰਕੇ ਗਾਂਧੀ ਜੀ ਨੇ ਖਾਦੀ ਕੱਪੜੇ ਨੂੰ ਇੱਕ ਹਥਿਆਰ ਬਣਾਇਆ ਸੀ ਅਤੇ ਅੰਗਰੇਜ਼ਾਂ ਦਾ ਕੱਪੜਾ ਇੱਥੇ ਆ ਕੇ ਬਾਈਕਾਟ ਕੀਤਾ ਸੀ ਅਤੇ ਅੰਗਰੇਜ਼ਾਂ ਨੂੰ ਭਾਰਤ ਤੋਂ ਭਜਾਇਆ ਸੀ ਤਾਂ ਇੱਕ ਕੱਪੜੇ ਨਾਲ਼ ਹੀ ਇੱਕ ਕੱਪੜੇ ਦਾ ਹੀ ਕਿੱਡਾ ਵੱਡਾ ਯੋਗਦਾਨ ਸੀ ਸਾਡੇ ਆਜ਼ਾਦੀ ਭਾਰਤ ਦੀ ਆਜ਼ਾਦੀ ਦੇ ਵਿੱਚ ਅਤੇ ਇਸ ਤਰੀਕੇ ਨਾਲ਼ ਜੇ ਉਹ ਇੱਕ ਕੱਪੜੇ ਨੂੰ ਇੰਨੀ ਮਹੱਤਤਾ ਦਿੰਦੇ ਸੀ ਤਾਂ ਸਾਨੂੰ ਵੀ ਆਪਣੇ ਪੰਜਾਬ ਆਪਣੇ ਭਾਰਤ ਵਿੱਚ ਬਣੇ ਹੋਏ ਕੱਪੜੇ ਨੂੰ ਹੀ ਮਹੱਤਵ ਦੇਣਾ ਚਾਹੀਦਾ ਹੈ ਬਲਕਿ ਇੱਕ ਰੇਡੀਮੇਡ ਜਾਂ ਬਾਹਰ ਦੇ ਬਣੇ ਹੋਏ ਕੱਪੜੇ ਨਾਲ਼ੋਂ